ਹੈਲੋ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਪੁੱਛੋ ਜੀ ਮੈਂ ਸਰ ਹੋ ਗਏ ਜੀ ਤਕਰੀਬਨ ਤਿੰਨ ਕੁ ਸਾਲ ਜੀ ਹਾਂਜੀ ਹਾਂਜੀ ਨਹੀਂ ਸਰ ਨਹੀਂ ਪਹਿਲਾਂ ਬੜੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹੁੰਦੇ ਆ ਜੀ ਹੜ੍ਹਾਂ ਤੋਂ ਰੋਕਥਾਮ ਲਈ ਓਲਰੇਡੀ ਪਹਿਲਾਂ ਤੋਂ ਹੀ ਪਿਛਲੇ ਸਾਲ ਵੀ ਕੁਝ ਜ਼ਿਆਦਾ ਬਾਰਿਸ਼ ਹੋਣ ਕਰਕੇ ਇਸ ਤਰ੍ਹਾਂ ਦੇ ਹੜ੍ਹ ਆ ਗਏ ਨਹੀਂ ਅਦਰਵਾਈਜ਼ ਸਾਡੇ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਆ ਜੀ ਹੜ੍ਹਾਂ ਦੀ ਰੋਕਥਾਮ ਲਈ ਪਹਿਲਾਂ ਤੋਂ ਹੀ ਹਾਂਜੀ ਇਹ ਸਰ ਬਸ ਮੰਨੋ ਤੁਸੀਂ ਉੱਪਰ ਜ਼ਿਆਦਾ ਹੜ੍ਹ ਆਉਣ ਕਰਕੇ ਜਾ ਪਾਣੀ ਉ ਪਹਿਲਾਂ ਪਿੱਛੋਂ ਵੀ ਮੀਂਹ ਜ਼ਿਆਦਾ ਆਉਣ ਕਰਕੇ ਬਰਸਾਤਾਂ ਜ਼ਿਆਦਾ ਹੋਣ ਕਾਰਨ ਇਹ ਹੀ ਹੋ ਗਿਆ ਇਹ

ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਸਰ ਬਿਲਕੁਲ ਇਸ 'ਚ ਕੋਈ ਸੱਚਾਈ ਨਹੀਂ ਹੈ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਗਏ ਸੀ ਕੁਦਰਤੀ ਹੀ ਜ਼ਿਆਦਾ ਹੜ੍ਹ ਆਉਣ ਦੇ ਕਾਰਨ ਜੋ ਇਹ ਜ਼ਿਆਦਾ ਬਰਸਾਤਾਂ ਹੋਣ ਦੇ ਕਾਰਨ ਹੜ੍ਹ ਜਿਹੜੇ ਕਾਰਨ ਬਣੇ ਨੇ ਨਹੀਂ ਅਦਰਵਾਈਜ਼ ਪੂਰੇ ਸਾਡੇ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਜਾਂਦੇ ਨੇ ਹਰ ਸਾਲ ਔਰ ਕੀਤੇ ਵੀ ਗਏ ਸੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੋ ਕਮੀਆਂ ਸਾਨੂੰ ਦਿੱਖ ਰਹੀਆਂ ਨੇ ਅਤੇ ਅਸੀਂ ਉਹਨਾਂ ਨੂੰ ਜ਼ਰੂਰ ਪੂਰਾ ਕਰਨ ਦੀ ਕੋਸ਼ਿਸ਼ ਕਰ ਵੀ ਰਹੇ ਹਾਂ ਅਤੇ ਅੱਗੇ ਵੀ ਕਰਾਂਗੇ ਤਾਂ ਕੇ ਅੱਗੇ ਤੋਂ ਜੋ ਹਾਂਜੀ ਹਾਂਜੀ ਉਹ ਸਰਕਾਰ ਤੱਕ ਅਸੀਂ ਪਹੁੰਚਾ ਚੁੱਕੇ ਹਾਂ ਜੀ ਪੂਰੀ ਰਿਪੋਰਟ ਔਰ ਬਹੁਤ ਹੀ ਜਲਦੀ ਉਹਨਾਂ ਨੂੰ ਜੋ ਹੈ ਮੁਆਵਜ਼ਾ ਕੁਛ ਕਿਸਾਨਾਂ ਨੂੰ ਦਿੱਤਾ ਜਾ ਚੁੱਕਿਆ ਅਤੇ ਕੁਛ ਨੂੰ ਦਿੱਤਾ ਜਾਵੇਗਾ ਜੀ ਠੀਕ ਓਕੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ